ਹਲੋ ਸਤਿ ਸ਼੍ਰੀ ਅਕਾਲ ਮੈਮ ਠੀਕ ਹੂੰ ਆਪ ਬਤਾਓ ਬਸ ਹੋਰ ਬੱਚਿਆਂ ਦੇ ਪੇਪਰ ਹੋਏ ਸੀ ਅਤੇ ਤੁਸੀਂ ਰਿਜ਼ਲਟ ਲੈਣ ਨਹੀਂ ਆਏ ਰਿਜ਼ਲਟ ਤਾਂ ਇੱਦਾਂ ਤੁਹਾਡੇ ਬੱਚੇ ਦਾ ਠੀਕ ਹੈ ਬਟ ਇੰਗਲਿਸ਼ 'ਚ ਥੋੜ੍ਹਾ ਵੀਕ ਹੈ ਪਰ ਪੇਪਰ ਤਾਂ ਹੁਣ ਛੋਟੇ ਆ ਨਾ ਪੇਪਰ ਦਿਖਾ ਨਹੀਂ ਸਕਦੇ ਜਾਂ ਤੁਸੀਂ ਸਕੂਲ ਆਇਓ ਅਤੇ ਸਕੂਲ ਆ ਕੇ ਦੇਖ ਦੇਖ ਲਿਓ ਰਿਜ਼ਲਟ ਦੇਖ ਲਿਓ ਤੁਸੀਂ ਪੜ੍ਹਨੇ ਵਿੱਚ ਇੱਦਾਂ ਤਾਂ ਬਿਲਕੁਲ ਠੀਕ ਹੈ ਨੰਬਰ ਤਾਂ ਠੀਕ ਹੈ ਬਟ ਇੰਗਲਿਸ਼ 'ਚੋਂ ਨਾ ਥੋੜ੍ਹਾ ਵੀਕ ਹੈ ਇਹ ਇੰਗਲਿਸ਼ 'ਚੋਂ ਇਹਨੂੰ ਥੋੜ੍ਹੇ ਮਿਹਨਤ ਕਰਵਾਓ ਜ਼ਿਆਦਾ ਤੋਂ ਜ਼ਿਆਦਾ ਠੀਕ ਹੈ ਬਸ ਠੀਕ ਆ ਬਡਮੀਸ਼ਨ ਹੁਣ ਓਪਨ ਹੋ ਜਾਣੀ ਆ ਤੁਸੀਂ ਐਡਮਿਸ਼ਨ ਕਰਵਾ ਲਓ ਅਤੇ ਬੁੱਕਸ ਵਗੈਰਾ ਲੈ ਲਓ ਸਕੂਲ ਆ ਕੇ ਠੀਕ ਹੈ ਹਾਂਜੀ ਠੈਂਕ ਯੂ ਠੈਂਕ ਯੂ ਜੀ ਠੈਂਕ ਯੂ